ਗਿਆਰਾਂ ਮਈ ਉੱਨੀ ਸੌ ਅਠਾਨਵੇਂ ਅਠਾਈ ਮਾਰਚ ਉੱਨੀ ਸੌ ਨੜਿਨਵੇਂ ਪੰਜ ਸਤੰਬਰ ਦੋ ਹਜ਼ਾਰ ਦੋ ਦੋ ਅਕਤੂਬਰ ਦੋ ਹਜ਼ਾਰ ਪੰਜ ਛੇ ਦਸੰਬਰ ਦੋ ਹਜ਼ਾਰ ਨੌ